ਧਾਰਮਿਕ ਅਸਥਾਨਾਂ 'ਤੇ ਜਿਵੇਂ ਕਿ ਗੁਰਦੁਆਰੇ ਵਿੱਚ ਪਾਠ ਕੀਤਾ ਜਾਂਦਾ ਹੈ ਅਤੇ ਕੀਰਤਨ ਕੀਤਾ ਜਾਂਦਾ ਹੈ ਜਿਵੇਂ ਕਿ ਉਸ ਦੇ ਲਈ ਅਲੱਗ ਅਲੱਗ ਮੌਕੇ ਹੁੰਦੇ ਹਨ ਜਿਵੇਂ ਕਿ ਗੁਰੂ ਨਾਨਕ ਪੁਰਬ ਪੁਰਬ 'ਤੇ ਪਾਠ ਕੀਤਾ ਜਾਂਦਾ ਹੈ ਕਿਸੇ ਵੀ ਗੁਰੂ ਦੇ ਪੁਰਬ ਪੁਰਬ 'ਤੇ ਪਾਠ ਕੀਤਾ ਜਾਂਦਾ ਹੈ ਅਤੇ ਕੀਰਤਨ ਵੀ ਕੀਤਾ ਜਾਂਦਾ ਹੈ ਅਤੇ ਉਵੇਂ ਹੀ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਹੁੰਦੇ ਏ ਉਦੋਂ ਵੀ ਪਾਠ ਕੀਤਾ ਜਾਂਦਾ ਹੈ ਅਤੇ ਉਸ ਤੋਂ ਉਪਰੰਤ ਠੰਡੇ ਮਿੱਠੇ ਜਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ ਉਸ ਤੋਂ ਬਾਅਦ ਮੰਦਰਾਂ ਵਿੱਚ ਭਜਨ ਭਜਨ ਆਦਿ ਗਾਏ ਜਾਂਦ ਭਜਨ ਗਾਏ ਜਾਂਦੇ ਹਨ ਜ ਅਤੇ ਭੇਟਾਂ ਗਾਈਆਂ ਜਾਂਦੀਆਂ ਹਨ ਵਹੀਂ ਮਸਜਿਦਾਂ ਵਿੱਚ ਵੀ ਵੀ ਇੱਕ ਪ ਇੱਕ ਸਮੂਹਿਕ ਪ੍ਰਾਥਨਾ ਕੀਤੀ ਜਾਂਦੀ ਹੈ ਅਤੇ ਜਿਵੇਂ ਕਿ ਸ਼ਿਵ ਜੀ ਦੀ ਸ਼ਿਵਰਾਤਰੀ 'ਤੇ ਵੀ ਸ਼ਿਵਰਾਤਰੀ 'ਤੇ ਸਾਰਾ ਸ਼ਿਵਰਾਤਰੀ 'ਤੇ ਵੀ ਸ਼ਬ ਸੰਗੀਤ ਲਗਾਏ ਜਾਂਦੇ ਹਨ ਅਤੇ ਸੰਗੀਤ ਲਗਾਏ ਜਾਂਦੇ ਹਨ